ਮੋਹਾਲੀ ਜ਼ਿਲ੍ਹੇ ਵਿੱਚ ਗਤੀਆਂ ਅਤੇ ਮਨੋਰੰਜਨ ਵਾਸਤੇ ਬਹੁਤ ਵਿਕਲਪ ਹਨ ਇੱਕ ਵੀ ਆਰ ਮੋਲ ਹੈ ਕਾਫ਼ੀ ਵੱਡਾ ਮੋਲ ਹੈ ਉੱਥੇ ਕਾਫ਼ੀ ਤਰ੍ਹਾਂ ਦੀ ਸ਼ੋਪਿੰਗ ਹੰ ਹੋ ਜਾਂਦੀ ਹੈ ਅਤੇ ਇੰਟਰਟੇਨਮੈਂਟ ਲਈ ਸਿਨੇਮਾ ਘਰ ਵਗੈਰਾ ਪੀ ਵੀ ਆਰ ਮੋਲ ਹੈਗੇ ਨੇ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਇੱਥੇ ਗੇਮਾਂ ਖਿਡਾਈਆਂ ਜਾਂਦੀਆਂ ਹਨ ਅਤੇ ਦੂਸਰੇ ਨੰਬਰ 'ਤੇ ਮੇਲੇ ਵਗੈਰਾ ਬਹੁਤ ਲੱਗਦੇ ਰਹਿੰਦੇ ਹਨ ਜਿੱਥੇ ਬਹੁਤ ਸਾਰੇ ਕਲਾਕਾਰਾਂ ਨੂੰ ਆਪਣੇ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਦਾ ਹੈਗਾ ਚਾਹੇ ਤੁਸੀਂ ਗਾਇਕੀ ਲੈ ਲਓ ਜਾਂ ਭਲਵਾਨੀ ਲੈ ਲਓ ਤੁਸੀਂ ਅਤੇ ਯਾ ਕੋਈ ਵਧੀਆ ਖਿਡਾਰੀ ਹੋਵੇ ਆਪਣੇ ਆਪਣੀ ਲੋਕ ਗੀਤ ਵਗੈਰਾ ਉੱਥੇ ਗਾਏ ਜਾਂਦੇ ਨੇ ਅਤੇ ਹੋਰਾਂ ਨੂੰ ਜਿਸ ਤਰ੍ਹਾਂ ਕਿਸੇ ਨੇ ਕਬੱਡੀ ਖੇਡਣੀ ਹੋਵੇ ਤਾਂ ਉੱਥੇ ਹਰੇਕ ਨੂੰ ਮੌਕਾ ਦਿੱਤਾ ਜਾਂਦਾ ਅਤੇ ਇਸ ਤੋਂ ਇਲਾਵਾ ਇੱਥੇ ਸਟੇਡੀਅਮ ਵੀ ਹੈਗੇ ਨੇ ਕ੍ਰਿਕਟ ਸਟੇਡੀਅਮ ਹੈ ਹੋਕੀ ਸਟੇਡੀਅਮ ਹੈ ਜੇ ਤੁਸੀਂ ਖੇਡਣਾ ਖੇਡ ਸਕਦੇ ਹੋ ਅਗਰ ਤੁਸੀਂ ਮੈਚ ਦੇਖਣਾ ਉਹ ਦੇਖ ਸਕਦੇ ਓਂ ਅਤੇ ਦੋਨੋਂ ਤਰ੍ਹਾਂ ਦੀਆਂ ਗਤੀਵਿਧੀਆਂ ਹੋ ਸਕਦੀਆਂ ਨੇ ਅਤੇ ਵੈਸੇ ਜਿਹੜੇ ਵੀ ਆਰ ਮੋਲ ਹੈਗਾ ਬੈਸਟਕ ਮੋਲ ਹੈਗਾ ਐਂਟਰੀ ਟਿਕਟ ਤਾਂ ਇਹਨਾਂ ਦੀ ਕੋਈ ਨੀ ਹੈ ਪਰ ਫਿਰ ਵੀ ਅਗਰ ਤੁਸੀਂ ਉੱਥੇ ਕਿਸੇ ਗੇਮ 'ਚ ਹਿੱਸਾ ਲੈਣਾ ਤਾਂ ਤੁਹਾਨੂੰ ਕੁਝ ਨਾ ਕੁਝ ਤਾਂ ਪੇਅ ਕਰਨਾ ਹੀ ਪਏਗਾ ਉਹਨਾਂ ਨੂੰ ਅਤੇ ਵੈਸੇ ਜਿਹੜੇ ਆਮ ਆਪਣੇ ਮੇਲੇ ਲੱਗਦੇ ਆ ਨਾ ਉੱਥੇ ਕੋਈ ਐਂਟਰੀ ਫ਼ੀਸ ਵਗੈਰਾ ਨਹੀਂ ਹੁੰਦੀ ਉੱਥੇ ਤਾਂ ਸਗੋਂ ਤੁਹਾਨੂੰ ਇਨਾਮ ਮਿਲਦਾ ਕਿਸੇ ਨੂੰ ਦਸ ਹਜ਼ਾਰ ਇਨਾਮ ਕਿਸੇ ਨੂੰ ਪੰਜਾਹ ਹਜ਼ਾਰ ਇਨਾਮ ਕਿਸੇ ਨੂੰ ਕੋਈ ਮੋਟਰਸਾਈਕਲ ਗਿਫ਼ਟ ਹੋ ਗਿਆ ਕਿਸੇ ਨੂੰ ਵਾਸ਼ਿੰਗ ਮਸ਼ੀਨ ਵਗੈਰਾ ਗਿਫ਼ਟ ਮਿਲ ਜਾਂਦੀ ਹੈ ਅਤੇ ਇਸ ਲਈ ਮੋਹਾਲੀ ਜ਼ਿਲ੍ਹੇ 'ਚ ਬਹੁਤ ਸਾਰੇ ਮਨੋਰੰਜਨ ਦੇ ਸਾਧਨ ਹੈਗੇ ਨੇ